ਸਾਡੇ ਖੇਤਰ ਦੇ ਵਿੱਚ ਆਮ ਤੌਰ 'ਤੇ ਲੋਹੜੀ ਵਿਸਾਖੀ ਮਕਰ ਸਕ੍ਰਾਂਤੀ ਦਿਵਾਲੀ ਇਹ ਤਿਉਹਾਰ ਮਨਾਏ ਜਾਂਦੇ ਹੈ ਮੈਂ ਅਕਸਰ ਇਹਨਾਂ ਤਿਉਹਾਰਾਂ ਦੇ ਵਿੱਚ ਨਹਾ ਧੋ ਕੇ ਨਵੇਂ ਕੱਪੜੇ ਪਾਉਂਦੀ ਹਾਂ ਸਾਫ਼ ਸਫ਼ਾਈ ਕੀਤੀ ਜਾਂਦੀ ਹੈ ਅਤੇ ਕਿਚਨ ਦੇ ਵਿੱਚ ਜਿਹੜੀਆਂ ਡਿਸ਼ਿਸ ਬਣਾਉਂਦੀ ਹਾਂ ਡਿਸ਼ਿਸ ਬਣਾਉਣ ਤੋਂ ਬਾਅਦ ਮੈਂ ਬਜ਼ਾਰ ਜਾਂਦੀ ਹਾਂ ਥੋੜ੍ਹੀ ਬਹੁਤੀ ਸ਼ੋਪਿੰਗ ਕਰਦੀ ਹਾਂ ਅਤੇ ਫਿਰ ਜਿਹੜੇ ਸਾਡੇ ਇਹਨਾਂ ਦਿਨਾਂ ਦੇ ਵਿੱਚ ਇੱਕ ਦੂਜੇ ਰਿਸ਼ਤੇਦਾਰ ਨੂੰ ਮਿਠਾਈਆਂ ਦਿੱਤੀਆਂ ਜਾਂਦੀਆਂ ਫਿਰ ਜੋ ਜਿਹੜਾ ਵੀ ਰਿਸ਼ਤੇਦਾਰ ਘਰ ਆਉਂਦਾ ਮੈਂ ਉਹਨੂੰ ਆਪਣੀਆਂ ਬਣਾਈਆਂ ਡਿਸ਼ਿਸ ਖੁਆਉਂਦੀ ਹਾਂ ਅਤੇ ਮਤਲਬ ਸ਼ਾਮ ਨੂੰ ਸਾਰੀ ਫੈਮਿਲੀ ਹੈ ਜਿਹੜੀ ਇਕੱਠੇ ਬੈਠ ਕੇ ਖਾਣਾ ਖਾਂਦੇ ਹਾਂ ਡਿਸ਼ਿਸ ਜਿਹੜੀਆਂ ਬਣਾਈਆਂ ਉਹਨਾਂ ਨੂੰ ਜਿਹੜਾ ਸਰਵ ਕੀਤਾ ਜਾਂਦਾ ਹੈ ਫੈਮਿਲੀ ਦੇ ਵਿੱਚ ਇਕੱਠੇ ਬੈਠ ਕੇ ਜਿਹੜੇ ਇਹਨਾਂ ਤਿਉਹਾਰਾਂ ਨੂੰ ਇੰਜੋਏ ਕੀਤਾ ਜਾਂਦਾ